ਮੇਰੇ ਕੋਲ ਸਮੇਂ ਸਮੇਂ 'ਤੇ ਬਹੁਤ ਜ਼ਿਆਦਾ ਫੋਨ ਆਏ ਸਾਰਿਆਂ ਦੇ ਪਹਿਲਾਂ ਆਪਣੇ ਕੋਲ ਦੋ ਹਜ਼ਾਰ ਪੰਜ ਛੇ ਦੇ ਵਿੱਚ ਨੋਕੀਆ ਗਿਆਰ੍ਹਾਂ ਸੌ ਮੋਬਾਈਲ ਫੋਨ ਆਇਆ ਪਰ ਇਸ ਦੇ ਉਲਟ ਅੱਜ ਦੇ ਅਜੌਕੇ ਸਮੇਂ ਦੇ ਵਿੱਚ ਮੇਰੇ ਕੋਲ ਦੋ ਹਜ਼ਾਰ ਚੌਵੀ ਦੇ ਵਿੱਚ ਐਪਲ ਦਾ ਜਿਹੜਾ ਆਈਫੋਨ ਟਵੈਲਵ ਪਰੋ ਕੰਮ ਕਰ ਰਿਹਾ ਉਸ ਸਮੇਂ ਦੀ ਟੈਕਨੋਲੋਜੀ ਨੂੰ ਅਗਰ ਅੱਜ ਅੱਜ ਦੇ ਸਮੇਂ ਦੇ ਨਾਲ ਅਜੋਕੇ ਸਮੇਂ ਦੇ ਨਾਲ ਆਪਾਂ ਜੋੜ ਕੇ ਦੇਖੀਏ ਤਾਂ ਬਹੁਤ ਸਾਰਾ ਸਾਨੂੰ ਬਦਲਾਅ ਨਜ਼ਰ ਆਉਂਦਾ ਉਦੋਂ ਦੇ ਜਿਹੜੇ ਫੋਨ ਸੀਗੇ ਉਦੋਂ ਦੇ ਜਿਹੜੇ ਹੈਂਡਸੈੱਟ ਸੀਗੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਾ ਤਾਂ ਕੋਈ ਕੈਮਰਾ ਸੀ ਨਾ ਕੋਈ ਮਿਊਜਿਕ ਸਿਸਟਮ ਸਿੱਖ ਸਿਰਫ ਅਤੇ ਸਿਰਫ ਰਿੰਗਟਿਊਨ ਸੀਗੀਆਂ ਪਰ ਉਸ ਦੇ ਉਲਟ ਅੱਜ ਦੇ ਸਮੇਂ ਦੇ ਵਿੱਚ ਫੋਨਾਂ ਦੇ ਵਿੱਚ ਮਿਊਜ਼ਕ ਟੈਕਨੋਲੋਜੀ ਵੀਡੀਓ ਕਾਲ ਦੀ ਜਿਹੜੀ ਪਰਿਭਾਸ਼ਾ ਇਹ ਕੈਮਰਾ ਵੀਡੀਓ ਕਾਲ ਫੈਸਿਲਿਟੀਆਂ ਔਰ ਜੀਪੀਐਸ ਦਾ ਜਿਹੜਾ ਸਿਸਟਮ ਆ ਉਹ ਸਾਨੂੰ ਕੰਮ ਕਰਦਾ ਨਜ਼ਰ ਆਉਂਦਾ ਪੁਰਾਣੇ ਸਮਿਆਂ ਦੇ ਫੋਨਾਂ ਦੇ ਵਿੱਚ ਸਵਿੱਚ ਆਲੇ ਫੋਨ ਸੀਗੇ ਔਰ ਛੋਟੀਆਂ ਸਕਰੀਨਾਂ ਪਰ ਇਸ ਦੇ ਉਲਟ ਅੱਜ ਦੇ ਸਮੇਂ ਦੇ ਵਿੱਚ ਵੱਡੇ ਟੱਚ ਵਾਲੇ ਫੋਨ ਜਿਹੜੇ ਛੇ ਪੁਆਇੰਟ ਤਿੰਨ ਛੇ ਪੁਆਇੰਟ ਚਾਰ ਛੇ ਪੁਆਇੰਟ ਪੰਜ ਇੰਚ ਦੀ ਸਕਰੀਨ ਔਰ ਵਿਦਆਊਟ ਸਵਿੱਚ ਟੱਚ ਸਕਰੀਨ ਜਿਹੜੇ ਫੋਨ ਆ ਸਾਨੂੰ ਨਜ਼ਰ ਆਉਂਦੇ ਸੋ ਬਹੁਤ ਸਾਰਾ ਬਦਲਾਅ ਟੈਕਨੋਲੋਜੀ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਜਿਹਨੂੰ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ ਏ